ਮੇਰਾ ਨਾਮ ਪ੍ਰਭਜੋਤ ਕੌਰ ਹੈ ਮੇਰਾ ਅਕਾਊਂਟ ਤੁਹਾਡੇ ਬੈਂਕ 'ਚ ਹੈ ਅਤੇ ਮੇਰੇ ਬੈਂਕ ਅਕਾਊਂਟ ਦਾ ਨੰਬਰ ਸੱਤ ਜੀਰੋ ਛੇ ਛੇ ਨੌਂ ਸੱਤ ਅੱਠ ਦੋ ਇੱਕ ਹੈ ਅਤੇ ਮੈਂ ਤੁਹਾਡੇ ਬੈਂਕ ਐਪ ਨਾਲ ਜੁੜਿਆ ਹੋਇਆ ਹਾਂ ਤੁਹਾਡੇ ਬੈਂਕ ਐਪ ਦੇ ਰਾਹੀਂ ਮੇਰੇ ਮੋਬਾਇਲ ਵਿੱਚੋਂ ਕੁਝ ਪੈਸੇ ਕੱਟੇ ਗਏ ਮੈਂ ਦੇਖਿਆ ਮਹੀਨੇ ਦੀ ਉਣੱਤੀ ਤਰੀਕ ਨੂੰ ਤੁਸੀਂ ਮੇਰੇ ਬੈਂਕ ਮੋਬਾਈਲ ਐਪ ਰਾਹੀਂ ਪੈਸੇ ਕੱਟ ਲਏ ਜੋ ਕਿ ਮੈਂ ਉਹ ਪੈਸੇ ਇੱਕ ਚੈੱਕ ਰਾਹੀਂ ਦੇ ਚੁੱਕੀ ਸੀ ਪਰ ਫਿਰ ਵੀ ਤੁਸੀਂ ਮੇਰੇ ਮੋਬਾਈਲ ਐਪ 'ਚੋਂ ਪੈਸੇ ਕੱਟ ਲਏ ਅਤੇ ਮੈਂ ਇਸ ਬਾਰੇ ਥੋੜ੍ਹੀ ਚਿੰਤਿਤ ਹਾਂ ਮੈਨੂੰ ਇਸ ਬਾਰੇ ਦੱਸੋ ਕਿ ਤੁਸੀਂ ਮੇਰੇ ਮੋਬਾਈਲ ਐਪ 'ਚੋਂ ਪੈਸੇ ਕਿਉਂ ਕੱਟੇ ਤਾਂ ਕਿ ਮੈਂ ਆਪਣੇ ਮਨ ਦੀ ਸੰਤੁਸ਼ਟੀ ਕਰ ਪਾਵਾਂ